ਕਿ ਸਾਡੇ ਰੋਪੜ ਦੇ ਵਿੱਚ ਕੋਈ ਜਦੋਂ ਅਪਰਾਧ ਹੁੰਦਾ ਹੈ ਅਤੇ ਉਸਦੀ ਸੁਰੱਖਿਆ ਲਈ ਪੁਲਿਸ ਆਉ ਪੁਲਿਸ ਨੂੰ ਅਸੀਂ ਬੁਲਾਉਂਦੇ ਹਨ ਪੁਲਿਸ ਬਹੁਤ ਆਪਣੇ ਚੰਗੇ ਢੰਗ ਦੇ ਨਾਲ ਤਰੀਕੇ ਦੇ ਨਾਲ ਅਪਰਾਧ ਨੂੰ ਦੂਰ ਕੀ ਕੀਤਾ ਜਾਂਦਾ ਹੈ